ਮੈਂ ਇੱਕ ਅਧਿਆਪਕ ਹਾਂ ਅਤੇ ਮੈਂ ਆਪਣੀ ਜਿਹੜੀ ਮੈਨੂੰ ਤਨਖਾਹ ਮਿਲਦੀ ਹੈ ਉਹਦੇ ਵਿੱਚੋਂ ਕੁਛ ਹਿੱਸੇ ਦਾ ਮੈਂ ਤ ਕਮੇਟੀਆਂ ਵੀ ਪਾਈਆਂ ਹੋਈਆਂ ਹਨ ਉਹ ਜਿਹਦੇ ਘਰ ਕਮੇਟੀ ਹੁੰਦੀ ਹੈ ਉਹਦੇ ਘਰ ਸਾਡੀ ਭਜਨ ਮੰਡਲੀ ਇਕੱਠੀ ਹੁੰਦੀ ਹੈ ਉਹ ਭਜਨ ਮੰਡਲੀ ਦੇ ਵਿੱਚ ਜਿਹਦੀ ਕਮੇਟੀ ਨਿਕਲਦੀ ਹੈ ਉਸੇ ਘਰ ਹੀ ਅਸੀਂ ਭਜਨ ਮੰਡਲੀ ਇਕੱਠੇ ਹੁੰਦੇ ਹਾਂ ਅਤੇ ਉਹ ਭਜਨ ਮੰਡਲੀ ਜਿਹੜੀ ਹੈ ਉਹ ਆਪਣੇ ਭਜਨ ਮੰਡਲੀ ਵਿੱਚ ਸੰਗੀਤ ਯੰਤਰਾਂ ਦੀ ਜਿਹੜੇ ਵਰਤੋਂ ਕਰਦੇ ਹਨ ਉਹ ਹੈਗੇ ਆ ਖੜਤਾਲਾ ਛੈਣੇ ਢੋਲਕੀ ਇਹ ਸਾਰੀਆਂ ਅਸੀਂ ਮੰਦਰ ਦੇ ਹੀ ਇਕੱਠੇ ਕੀਤੀ ਹੋਈ ਹੈ ਜਿਸ ਘਰ ਕਮੇਟੀ ਨਿਕਲਦੀ ਹੈ ਉਹ ਇਸ ਸਾਰੇ ਸਮਾਨ ਲੈ ਕੇ ਉਹ ਆਪਣੇ ਘਰ ਆਉਂਦੇ ਸਾਰੇ ਜਿਹੜੇ ਭਾ ਭਜਨ ਮੰਡਲੀ ਦੇ ਸੁਦੱਸ ਹੈਗੇ ਆ ਉਹ ਉਸੇ ਭਜਨ ਮੰਡਲੀ ਦੇ ਸਾਰੇ ਇਕੱਠੇ ਇੱਕੋ ਜਗ੍ਹਾ ਹੀ ਇਕੱਠੇ ਹੋ ਜਾਂਦੇ ਆ ਭਾਵੇਂ ਜਿਹਦੀ ਮਰਜ਼ੀ ਕਮੇਟੀ ਨਿਕਲੀ ਹੋਵੇ ਉਸੇ ਘਰ ਜਾ ਕੇ ਅਸੀਂ ਉਹ ਭਜਨ ਮੰਡਲੀ ਇਕੱਠੀ ਕਰ ਦਿੰਦੇ ਆ ਇਹ ਭਜਨ ਮੰਡਲੀ ਦੇ ਨਾਲ ਮੈਨੂੰ ਬਹੁਤ ਸਾਰੇ ਭਜਨ ਆ ਗਏ ਹਨ ਅਤੇ ਵਧੀਆ ਲੱਗਦਾ ਹੈ ਭਜਨ ਮੰਡਲੀ ਵਿੱਚ ਜਾ ਕੇ ਅਸੀਂ ਮੰਡਲੀ ਦੇ ਜਿਹੜਾ ਸਮਾਨ ਹੈ ਢੋਲਕੀ ਵਗੈਰਾ ਜਿਸ ਦੇ ਘਰ ਕੀਰਤਨ ਹੁੰਦਾ ਹੈ ਉਸ ਘਰ ਪਹਿਲੇ ਹੀ ਬਣਵਾ ਕੇ ਰੱਖ ਲੈਂਦੇ ਹਨ ਅਤੇ ਭਜਨ ਮੰਡਲੀ ਦੇ ਵਿੱਚ ਪ੍ਰਸ਼ਾਦ ਵੀ ਅਸੀਂ ਬਣਾ ਕੇ ਰੱਖ ਲਈਦਾ ਭਜਨ ਮੰਡਲੀ ਦੇ ਵਿੱਚ ਖੜਤਾਲਾ ਆਦਿ ਦਾ ਤੁੰਬਾ ਆਦਿ ਵਰਤ ਵਰਤੇ ਕੀਤੇ ਜਾਂਦੇ ਹੈ ਅਤੇ ਉਹਦੇ ਵਿੱਚ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ ਭਜਨ ਗਾ ਕੇ ਤਾਂ ਕਿ ਅਸੀਂ ਹੋਰ ਵੀ ਦੁਬਾਰਾ ਜਿਹਦੇ ਕਮੇਟੀ ਨਿਕਲਦੀ ਹੈ ਫਿਰ ਉਸ ਦੇ ਘਰ ਇਕੱਠੇ ਹੋ ਜਾਂਦੇ ਹਾਂ ਅਤੇ ਸ ਫਿਰ ਇਹ ਸਾਰਾ ਸਮਾਨ ਲੈ ਕੇ ਬਜਾਏ ਜਾਂਦੇ ਹੈ ਉਹਦੇ ਵਿੱਚ ਭਜਨ ਮੰਡਲੀ ਜਿਹੜੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਜਾਈ ਜਾਂਦੀ ਹੈ ਅਤੇ ਬਹੁਤ ਹੀ ਅੱਛਾ ਸ਼ਾਨਦਾਰ ਉਹਦੇ ਵਿੱਚ ਪ੍ਰੋਗਰਾਮ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਨਾਲ ਹੀ ਅਸੀਂ ਪ੍ਰਭੂ ਦਾ ਗੁਣਗਾਨ ਕਰ ਸਕਦੇ ਐਂ ਭਜਨ ਮੰਡਲੀ ਦੇ ਦਿਆਲ ਹੀ ਸਾਡਾ ਧਾਰਮਿਕ ਵਿਸ਼ਵਾਸ ਜਾਗ੍ਰਿਤ ਹੁੰਦਾ ਹੈ ਅਤੇ ਨਾਲ ਹੀ ਅਸੀਂ ਬਹੁਤ ਹੀ ਅੱਛਾ ਭਜਨ ਸੁਣ ਸਕਦੇ ਹਾਂ ਭਜਨ ਮੰਡਲੀ ਦੇ ਵਿੱਚ ਵੀ ਬਹੁਤ ਅੱਛੀ ਤਰੀਕੇ ਦੇ ਨਾਲ ਹੀ ਗੁਣਗਾਨ ਕੀਤਾ ਜਾਂਦਾ ਪ੍ਰਭੂ ਦਾ ਜਿਹੜਾ ਸੰਗੀਤ ਹੈ ਉਹ ਸਾਰੇ ਉਹ ਭਜਨ ਮੰਡਲੀ ਦੇ ਹੀ ਹੁੰਦੇ ਹੈ ਉਹ ਕਿਸੇ ਦੇ ਆਪਣੇ ਨਹੀਂ ਹੈਗੇ